ਸਾਡੀ ਪੰਜਾਬੀ ਭਾਸ਼ਾ ਹੀ ਬਹੁਤ ਸਾਡੇ ਲਈ ਮਹੱਤਵਪੂਰਨ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਮਾਂ ਭਾਸ਼ਾ ਅਤੇ ਅੱਛੀ ਭਾਸ਼ਾ ਹੈ ਅਸੀਂ ਹੋਰ ਭਾਸ਼ਾ ਨਾਲ਼ ਨਹੀਂ ਜੁੜ ਸਕਦੇ ਅਤੇ ਸਾਡੀ ਮਾਤ ਭਾਸ਼ਾ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਸਾਨੂੰ ਹੋਰ ਦੇਸ਼ਾਂ ਵਿੱਚ ਜਾ ਕੇ ਵੀ ਅਸੀਂ ਆਪਣੀ ਮਾਂ ਭਾਸ਼ਾ ਨੂੰ ਨਹੀਂ ਭੁਲਾ ਸਕਦੇ ਅਤੇ ਅਸੀਂ ਮਾਂ ਭਾਸ਼ਾ ਨਾਲ਼ ਹੀ ਜੁੜਨਾ ਹੈ ਅਸੀਂ ਹੋਰ ਭਾਸ਼ਾ ਵਿੱਚ ਨਹੀਂ ਜਾਣਾ ਚਾਹੁੰਦੇ ਅਤੇ ਅਸੀਂ ਆਪਣੀ ਪੰਜਾਬੀ ਭਾਸ਼ਾ ਦੀ ਹੀ ਪ੍ਰਸ਼ੰਸਾ ਕਰਦੇ ਹਾਂ